ਬਾਈਕਿੰਗ ਸਾਡੇ ਜੀਵਨ 'ਚ ਬਹੁਤ ਪ੍ਰਭਾਵ ਪਾਉਂਦੀ ਆ ਬਾਈਕਿੰਗ ਦੇ ਨਾਲ ਸਾਨੂੰ ਹੋਰ ਵੀ ਬੜੀਆਂ ਸਹਾਇਤਾਂ ਹੋ ਜਾਂਦੀਆਂ ਹਨ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਕਈ ਵਾਰੀ ਜਾ ਰਹੇ ਹੁੰਦੇ ਹਾਂ ਅਤੇ ਸਾਨੂੰ ਕੋਈ ਵੀ ਵਿਨ ਕਨਵੈਂਸ ਨਹੀਂ ਸਾਡੇ ਕੋਲ ਅਵੇਲੇਬਲ ਹੁੰਦੀ ਕਈ ਵਾਰੀ ਕੋਈ ਆਪਣੀ ਚੀਜ਼ ਆਪਣੀ ਕਨਵੈਂਸ ਖਰਾਬ ਹੋਈ ਹੁੰਦੀ ਹੈ ਅਤੇ ਅਸੀਂ ਜਾ ਰਹੇ ਹੁੰਦੇ ਹਾਂ ਰਸਤੇ 'ਚ ਸਾਨੂੰ ਕੋਈ ਮਿਲ ਜਾਵੇ ਤਾਂ ਅਸੀਂ ਉਹਦੇ ਕੋਲ ਲਿਫਟ ਮੰਗ ਲੈਂਦੇ ਹਾਂ ਉਹਦੇ ਨਾਲ ਲਿਫਟ ਮੰਗਣ ਨਾਲ ਉਹ ਸਾਡੀ ਸਹਾਇਤਾ ਹੋ ਜਾਂਦੀ ਹੈ ਤਾਂ ਉਹ ਆਪਸ 'ਚ ਅਸੀਂ ਦੋ ਬੰਦੇ ਜਾਂਦੇ ਹਾਂ ਅਤੇ ਉਹ ਗੱਲਾਂ ਹੁੰਦੀਆਂ ਆਪਸ 'ਚ ਅਸੀਂ ਉਹਦੇ ਬਾਰੇ ਪੁੱਛਦੇ ਹਾਂ ਉਹ ਸਾਡੇ ਬਾਰੇ ਪੁੱਛਦਾ ਹੈ ਆਪਸ 'ਚ ਇੱਕ ਦੂਸਰੇ ਦੀ ਇੱਕ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਕਿੱਥੇ ਰਹਿੰਦੇ ਹਾਂ ਰਸਤੇ 'ਚ ਗੱਲਾਂ ਕਰਦੇ ਹੋਰ ਕਈ ਗੱਲਾਂ ਅਸੀਂ ਆਪਸ 'ਚ ਸ਼ੇਅਰ ਕਰਦੇ ਕਰਦੇ ਜਾਂਦੇ ਹਾਂ ਕਈ ਵਾਰੀ ਮੈਂ ਵੀ ਜਦੋਂ ਜਾ ਰਿਹਾ ਹੁੰਦਾ ਹਾਂ ਕਈ ਵਾਰੀ ਕੋਈ ਬਜ਼ੁਰਗ ਇੱਕ ਵਾਰੀ ਮੈਨੂੰ ਕੋਈ ਬਜ਼ੁਰਗ ਆਦਮੀ ਮਿਲ ਗਿਆ ਮੈਂ ਉਹਨੂੰ ਆਪਣੀ ਬਾਈਕ 'ਤੇ ਬਿਠਾ ਕੇ ਉਹਨੂੰ ਰਸਤੇ 'ਚ ਜਿੱਥੇ ਉਹਨੇ ਜਾਣਾ ਸੀ ਉਹਨੂੰ ਉਤਾਰ ਦਿੱਤਾ ਉਹਨੇ ਮੈਨੂੰ ਸਾਰਾ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਅਤੇ ਮੈਂ ਉਹਨੂੰ ਕਿਹਾ ਮੈਂ ਇੱਥੇ ਰਹਿੰਦਾ ਹਾਂ ਅਸੀਂ ਮੈਂ ਇਸ ਤਰ੍ਹਾਂ ਜੋਬ ਕਰਨਾ ਹਾਂ ਅਤੇ ਉਹ ਮੈਂ ਉਹਨੂੰ ਉਤਾਰਿਆ ਅਤੇ ਉਹਨੇ ਮੈਨੂੰ ਬੜੀਆਂ ਅਸੀਸਾਂ ਦਿੱਤੀਆਂ ਉਹਨੇ ਮੈਨੂੰ ਬੜਾ ਬੜਾ ਧੰਨਵਾਦ ਕੀਤਾ ਔਰ ਬਾਈਕਿੰਗ ਦੀ ਗੱਲ ਕਰਾਂ ਤਾਂ ਮੈਂ ਅੱਜ ਤੋਂ ਕੁਛ ਸਾਲ ਪਹਿਲਾਂ ਦਿੱਲੀ ਔਰ ਨੋਇਡਾ ਦੇ ਵਿੱਚ ਵੀ ਜੋਬ ਕਰਦਾ ਸੀ ਉੱਥੇ ਮੈਂ ਬਹੁਤ ਬਾਈਕ ਦੇ ਵਿੱਚ ਬਹੁਤ ਜ਼ਿਆਦਾ ਘੁੰਮਿਆ ਮੈਂ ਬਾਈਕ ਦੇ ਵਿੱਚ ਹੀ ਉੱਥੇ ਦਿੱਲੀ ਤੋਂ ਨੋਇਡਾ ਚਲ ਜਾਣਾ ਨੋਇਡਾ ਤੋਂ ਕਈ ਵਾਰੀ ਅਸੀਂ ਗੁੜਗਾਵਾਂ ਚਲ ਜਾਣਾ ਬਾਈਕ ਦੇ ਉੱਤੇ ਹੀ ਮੈਂ ਉੱਥੇ ਵ੍ਰਿੰਦਾਵਨ ਘੁੰਮ ਕੇ ਆਇਆ ਔਰ ਵ੍ਰਿੰਦਾਵਨ ਦੇ ਵਿੱਚ ਮੈਂ ਕਾਫ਼ੀ ਸਾਰੇ ਮੰਦਿਰ ਦੇਖੇ ਉੱਥੇ ਮੈਂ ਉੱਥੇ ਮੇਰਾ ਬਹੁਤ ਜ਼ਿਆਦਾ ਮਤਲਬ ਕਿ ਵ੍ਰਿੰਦਾਵਨ 'ਚ ਮੇਰਾ ਬਹੁਤ ਜ਼ਿਆਦਾ ਦਿਲ ਲੱਗਦਾ ਵ੍ਰਿੰਦਾਵਨ ਦੇ ਵਿੱਚ ਅਸੀਂ ਜਾਈਦਾ ਹੈ ਉੱਥੇ ਪਹਿਲੇ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰੀਦੇ ਹੈ ਫਿਰ ਅਸੀਂ ਉੱਥੇ ਹੋਰ ਵੀ ਕਈ ਸਾਰੇ ਮੰਦਿਰ ਹੈਗੇ ਹਨ ਫਿਰ ਅਸੀਂ ਵ੍ਰਿੰਦਾਵਨ ਤੋਂ ਵ੍ਰਿੰਦਾਵਨ ਹੋ ਗਈ ਜਾਂ ਵ੍ਰਿੰਦਾਵਨ ਤੋਂ ਪਹਿਲਾਂ ਅਸੀਂ ਫਿਰ ਕੀ ਕਹਿੰਦੇ ਆ ਅਸੀਂ ਗੋਵਰਧਨ ਪਰਬਤ ਦੀ ਵੀ ਪਰਿਕਰਮਾ ਲਗਾਈ ਹੈ ਪਰਿਕਰਮਾ ਦੇ ਵਿੱਚ ਅਸੀਂ ਮਤਲਬ ਕਿ ਬਹੁਤ ਸਾਰੀ ਦੁਨੀਆ ਮਿਲਦੀ ਨੇ ਆਪਸ 'ਚ ਰਾਧੇ ਰਾਧੇ ਕਰਦੇ ਹੋਏ ਅਸੀਂ ਬਹੁਤ ਸਾਰੇ ਲੋਕ ਆਪਸ 'ਚ ਇਕੱਠੇ ਜਾਈਦਾ ਪਰਿਕਰਮਾ ਕਾਫ਼ੀ ਲੰਬੀ ਆ ਔਰ ਘੱਟ ਤੋਂ ਘੱਟ ਨਹੀਂ ਤਾਂ ਚਾਰ ਪੰਜ ਘੰਟੇ ਉਹਨੂੰ ਕਰਨ 'ਚ ਲੱਗ ਜਾਂਦੇ ਹਨ ਔਰ ਪਰਿਕਰਮਾ ਕਰਨ ਤੋਂ ਬਾਅਦ ਅਸੀਂ ਫਿਰ ਬਰਸਾਨੇ ਜਾਈਦਾ ਬਰਸਾਨੇ ਦੇ ਵਿੱਚ ਰਾਧਾ ਰਾਣੀ ਦਾ ਮਹਿਲ ਦੇਖਿਆ ਹੋਇਆ ਉਹ ਮਹਿਲ ਬਹੁਤ ਹੀ ਵਧੀਆ ਬਣਿਆ ਔਰ ਉੱਥੇ ਦਰਸ਼ਨ ਕਰਨ ਨੂੰ ਬੜਾ ਟਾਈਮ ਲੱਗਦਾ ਉੱਥੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ